ਯੋਗਾ ਕਲਾਸ ਦੀ ਗੱਲ ਕਰੀਏ ਤਾਂ ਮੈਂ ਸਕੂਲ ਟਾਈਮ ਯੋਗਾ ਦੀਆਂ ਕਲਾਸਾਂ ਲਗਾਈਆਂ ਹੋਈਆਂ ਨੇ ਅਤੇ ਹੁਣ ਮੈਂ ਜੋਬ ਕਰਦੀ ਹਾਂ ਤਾਂ ਯੂਨੀਵਰਸਿਟੀ ਦੇ ਵਿੱਚ ਵੀ ਕੈਂਪਸ ਲੱਗਦੇ ਨੇ ਯੋਗਾ ਦੇ ਤਾਂ ਮੈਂ ਯੋਗਾ ਕਰਦੀ ਹਾਂ ਸੈਚਰਡੇ ਸਸੰਡੇ ਵੀ ਮੈਂ ਯੋਗਾ ਕਰਦੀ ਹਾਂ ਮੇਰਾ ਯੋਗਾ ਜਿਹੜਾ ਕਰਨ ਨਾਲ ਹੈ ਮੇਰੀ ਜਿਹੜਾ ਮੇਰਾ ਮਾਇੰਡ ਹੈ ਉਹ ਫਰੈਸ਼ ਰਹਿੰਦਾ ਹੈਗਾ ਅਤੇ ਮੈਂ ਨਮ ਤਾਜ਼ਾ ਤਾਜ਼ਾ ਮਹਿਸੂਸ ਕਰਦੀ ਹਾਂ ਓਫਿਸ ਵਰਕ ਦੀ ਮੈਂ ਗੱਲ ਕਰਾਂ ਜਿਵੇਂ ਬੈਠੇ ਬੈਠੇ ਬੈਕ ਪੇਨ ਹੋ ਜਾਣਾ ਢੂਹੀ ਦੇ ਯੋਗਾ ਉਹਨਾਂ ਨੇ ਦੱਸੇ ਹੱਥ ਸੌ ਜਾਂਦੇ ਹੈ ਹੱਥਾਂ ਦੀ ਮੂਵਮੈਂਟ ਨੂੰ ਲੈ ਕੇ ਯੋਗਾ ਦੱਸੇ ਦਿਮਾਗ ਨੂੰ ਫਰੈਸ਼ ਕਰਨਾ ਉਨ ਉਸ ਬਾਰੇ ਉਹਨਾਂ ਨੇ ਯੋਗਾ ਦੱਸੇ ਸਾਡੇ ਪੈਰ ਸੌ ਜਾਂਦੇ ਨੇ ਪੈਰਾਂ ਪੈਰਾਂ ਦੀ ਮੂਵਮੈਂਟ ਅਤੇ ਆਦਿ ਮਤਲਬ ਜਿਹੜੀ ਵੀ ਸਾਨੂੰ ਸਰੀਰਿਕ ਪ੍ਰੋਬਲਮ ਆ ਸਾਰਾ ਸਾਨੂੰ ਕਲਾਸਾਂ ਦੇ ਵਿੱਚ ਦੱਸਿਆ ਜਾਂਦਾ ਸੀ ਤਾਂ ਮੇਰਾ ਜਿਹੜਾ ਯੋਗਾ ਕਰਨ ਦਾ ਐਕਸਪੀਰੀਅੰਸ ਹੈ ਬਹੁਤ ਵਧੀਆ ਹੁਣ ਮੈਂ ਜਦ ਵੀ ਫ੍ਰੀ ਹੁੰਦੀ ਹਾਂ ਨਾ ਮੈਂ ਘਰ ਆਪਣੇ ਜਦੋਂ ਕਰਦੀ ਹਾਂ ਤਾਂ ਮੇਰੇ ਬੱਚੇ ਵੀ ਮੈਨੂੰ ਦੇਖਦੇ ਆ ਅਤੇ ਮੈਂ ਆਪਣਿਆਂ ਵੱਡਿਆਂ ਨੂੰ ਵੀ ਦੱਸਦੀ ਹਾਂ ਤਾਂ ਮੈਨੂੰ ਇਹ ਮੈਂ ਇੱਕ ਮੇਰੇ ਘਰਦਿਆਂ ਨੂੰ ਫ੍ਰੀ ਟੀਚਰ ਮਿਲੀ ਹਾਂ ਯੋਗਾ ਲਈ ਜੋ ਕਿ ਉਹਨਾਂ ਦੀ ਵੀ ਜ਼ਿੰਦਗੀ ਹੈ ਜਿਹੜੀ ਸੌਖੀ ਹੋ ਗਈ ਆ ਉਹਨਾਂ ਨੂੰ ਉਹ ਵੀ ਜਦੋਂ ਯੋਗਾ ਕਰਦੇ ਆ ਤਾਂ ਉਹ ਵੀ ਤਾਜ਼ਾ ਤਾਜ਼ਾ ਮਹਿਸੂਸ ਕਰਦੇ ਆ ਉਹਨਾਂ ਦੀਆਂ ਵੀ ਕਈ ਬਿਮਾਰੀਆਂ ਜਿਹੜੀਆਂ ਉਹ ਘੱਟ ਚੁੱਕੀਆਂ ਨੇ ਤਾਂ ਸਾਨੂੰ ਬਹੁਤ ਚੰਗਾ ਲੱਗਦਾ ਹੈਗਾ ਅਤੇ ਯੂਨੀਵਰਸਿਟੀ ਦੇ ਵਿੱਚ ਮੈਂ ਜੋਬ ਕਰਦੀ ਹਾਂ ਅਤੇ ਯੂਨੀਵਰਸਿਟੀ ਦੇ ਵਿੱਚ ਇੱਕੀ ਜੂਨ ਨੂੰ ਕੈਂਪ ਲੱਗਦਾ ਹੈਗਾ ਅਤੇ ਮੈਂ ਉਹ ਉਹ ਕੈਂਪ ਕਦੇ ਜਾਣ ਨਹੀਂ ਦਿੰਦੀ ਮੈਂ ਉਸ ਕੈਂਪ ਨੂੰ ਜ਼ਰੂਰ ਲਗਾਉਂਦੀ ਹਾਂ ਤਾਂ ਕਿ ਸਾਡ ਅਸੀਂ ਸਿਹਤ ਪੱਖੋਂ ਫਿਟ ਰਹਿ ਸਕੀਏ ਮੈਂ ਇਹੀ ਸਲਾਹ ਦੇਣਾ ਚਾਹੁੰਦੀ ਹਾਂ ਵੀ ਯੋਗਾ ਸਾਨੂੰ ਕਦੇ ਵੀ ਮਿਸ ਉਹ ਮਿਸ ਨਹੀਂ ਕਰਨਾ ਚਾਹੀਦਾ ਕਦੇ ਵੀ ਸਾਨੂੰ ਮਤਲਬ ਉਹ